ਮੋਹਾਲੀ ਜ਼ਿਲ੍ਹੇ ਵਿੱਚ ਪੇਂਡੂ ਖੇਤਰ ਵਿੱਚ ਖੇਤੀਬਾੜੀ ਅਤੇ ਸ਼ਹਿਰੀ ਖੇਤਰ ਵਿੱਚ ਵਪਾਰ ਰੋਜ਼ੀ ਰੋਟੀ ਦੇ ਮੁੱਖ ਸ੍ਰੋਤ ਹਨ ਲੋਕ ਕੋਸ਼ਿਸ਼ ਤਾਂ ਕਰਦੇ ਹਨ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੇ ਪਰ ਇਹ ਹਰ ਇਨਸਾਨ ਦੇ ਕਰਮਾਂ ਵਿੱਚ ਨਹੀਂ ਹੁੰਦੀ ਸੋ ਜ਼ਿਆਦਾਤਰ ਲੋਕ ਨਿੱਜੀ ਨੌਕਰੀਆਂ ਸਵੈ ਰੁਜ਼ਗਾਰ ਅਤੇ ਆਪਣੇ ਵਪਾਰ ਕਰਦੇ ਹਨ ਮੋਹਾਲੀ ਜ਼ਿਲ੍ਹੇ ਵਿੱਚ ਬੇਰੁਜ਼ਗਾਰੀ ਬਹੁਤ ਹੱਦ ਤੱਕ ਪਿਛਲੇ ਸਮੇਂ ਨਾਲੋਂ ਘਟੀ ਹੈ